ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਇਹ ਯਾਨੀ ਕਿ ਕਪ ਜਿਹੜੇ ਸਲਵਾਰਾਂ ਦੀਆਂ ਮੂਹਰੀਆਂ ਬਾਰੇ ਦੱਸਣ ਲੱਗੀ ਹਾਂ ਕਿ ਅਲੱਗ ਅਲੱਗ ਡਿਜ਼ਾਇਨ ਕਿਵੇਂ ਬਣਾਉਣੇ ਆ ਜਾਂ ਕਿਵੇਂ ਆ ਕਿੱਥੋਂ ਮੈਂ ਸ਼ੁਰੂ ਕੀਤਾ ਕੰਮ ਮੈਂ ਆਪ ਖੁਦ ਕਰਦੀ ਪਈ ਹਾਂ ਸਟਿਚਿੰਗ ਦਾ ਕੰਮ ਇਸ ਟਾਈਮ ਵੀ ਬਚਪਨ ਤੋਂ ਵੀ ਮੈਨੂੰ ਸ਼ੌਕ ਸੀਗਾ ਬਚਪਨ ਤੋਂ ਇਹ ਸੀਗਾ ਕਿ ਜਦੋਂ ਮੈਂ ਥੋੜ੍ਹੀ ਜਿਹੀ ਵੱਡੀ ਹੋਈ ਦਸਵੀਂ ਕਲਾਸ ਟੱਪੀ ਯਾਨੀ ਕਿ ਉਸ ਤੋਂ ਬਾਅਦ ਮੈਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਭਤੀਜੀ ਦੇ ਮੈਂ ਕੱਪੜੇ ਯਾਨੀ ਕਿ ਬਣਾਉਣੇ ਆ ਅਤੇ ਪੁਰਾਣੇ ਕੱਪੜਿਆਂ ਤੋਂ ਸ਼ੁਰੂ ਕਰਤਾ ਭਾਬੀ ਦਾ ਕੋਈ ਸੂਟ ਲੈ ਲਿਆ ਉਹ ਤੋਂ ਸ਼ੁਰੂ ਕਰਤਾ ਉਸ ਤੋਂ ਬਾਅਦ ਹੀ ਮੇਰਾ ਸ਼ੌਕ ਪੂਰਾ ਵੱਧਦਾ ਗਿਆ ਗਿਆ ਬਿਲਕੁਲ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਇਹ ਜਿਹੜੀ ਕਟਿੰਗ ਹੈ ਮੈਂ ਆਪਣੀ ਦਾਦੀ ਤੋਂ ਸਿੱਖੀ ਬਿਨਾ ਇੰਚੀ ਟੇਪ ਤੋਂ ਦਾਦੀ ਤੋਂ ਸਿੱਖੀ ਉਸ ਤੋਂ ਜਦੋਂ ਉ ਉਸ ਤੋਂ ਬਾਅਦ ਮੈਂ ਆਪਣੀ ਯਾਨੀ ਕਿ ਜਦੋਂ ਸਹੁਰੇ ਘਰ ਆਈ ਮੈਂ ਪ੍ਰੋਪਰ ਆਪਣਾ ਕੰਮ ਸ਼ੁਰੂ ਕਰ ਲਿਆ ਮਸ਼ੀਨ ਦਾ ਮਸ਼ੀਨ ਦਾ ਕੰਮ ਕੀਤਾ ਅਤੇ ਜਦੋਂ ਇਹ ਜਿਹੜੀਆਂ ਸਲਵਾਰਾਂ ਬਾਰੇ ਦੱਸਣਾ ਇਹਨਾਂ ਦੇ ਯਾਨੀ ਕਿ ਜਿਹੜੀਆਂ ਸਲਵਾਰਾਂ ਨੇ ਇਹ ਕਈ ਤਰ੍ਹਾਂ ਦੀਆਂ ਬਣਦੀਆਂ ਯਾਨੀ ਕਿ ਜਦੋਂ ਕਟਿੰਗ ਆ ਜਿਹੜੀ ਪਹਿਲਾਂ ਇਹ ਇਹ ਡਬਲ ਵੀ ਹੋ ਜਾਂਦੀ ਆ ਪੂਰੀ ਪ ਫੁੱਲ ਪਟਿਆਲਾ ਸਲਵਾਰ ਦੀ ਵੀ ਹੁੰਦੀ ਆ ਸਿੰਪਲ ਸਲਵਾਰ ਦੀ ਵੀ ਕਿ ਇੱਕ ਨੈਰੋ ਸਲਵਾਰ ਅੱਜ ਕੱਲ੍ਹ ਚੱਲੀ ਆ ਜਿਹੜੀ ਉਹ ਵੀ ਚੱਲ ਰਹੀ ਆ ਜਿਹੜੇ ਇਹਨਾਂ ਦੇ ਪੌਂਚਿਆਂ ਦਾ ਡਿਜਾਇਨ ਹੈ ਪੌਂਚਿਆਂ ਦਾ ਡਿਜਾਇਨ ਆ ਯਾਨੀ ਕਿ ਮੈਨੂੰ ਇੱਕ ਜਿਹੜੇ ਪੌਂਚਿਆਂ ਜ ਇੱਕ ਤਾਂ ਕੁਛ ਜ਼ਿਆਦਾ ਹੀ ਚੌੜੇ ਚੱਲ ਰਹੇ ਆ ਜਿਹੜੇ ਆਮ ਤੌਰ 'ਤੇ ਕੁੜੀਆਂ ਪਹਿਲਾਂ ਪਾਉਂਦੀਆਂ ਹੁੰਦੀਆਂ ਸੀ ਹੁਣ ਨੋਰਮਲ ਵੀ ਚੱਲ ਪਏ ਆ ਕਿ ਜਿਵੇਂ ਜਿਵੇਂ ਡੇਢ ਇੰਚ ਦਾ ਦੋ ਇੰਚ ਦਾ ਜਿਹੜੇ ਕਟਾਂ ਵਾਲੇ ਆ ਯਾਨੀ ਕਿ ਕਈ ਇਹਨਾਂ 'ਤੇ ਡਿਜਾਇਨ ਪਾਉਂਦੇ ਆ ਸਲਵਾਰਾਂ ਦੇ ਪੌਂਚਿਆਂ ਦੇ ਲੈਸਾਂ ਲਾ ਕੇ ਵੀ ਤਿਆਰ ਕੀਤੇ ਜਾਂਦੇ ਨੇ ਜਿਹੜੀਆਂ ਆਪਾਂ ਬੁਕਰਮ ਜਿਹੜੀ ਵਿੱਚ ਪਾਉਂਦੇ ਹਾਂ ਵਧੀਆ ਤੋਂ ਵਧੀਆ ਬੁਕਰਮ ਪਾਈ ਹੋਵੇ ਉਹਦੇ 'ਤੇ ਡਿਜਾਈਨ ਉੱਦੂ ਵੀ ਜ਼ਿਆਦਾ ਸੋਹਣੇ ਬਣਦੇ ਨੇ ਅਤੇ ਜਿਹੜੇ ਕਟਾਂ ਵਾਲੇ ਆ ਜਿਹੜੇ ਜਿਵੇਂ ਥੱਲੇ ਕਟਾਂ ਤਿੱਖੇ ਵੀ ਬਣ ਜਾਂਦੇ ਆ ਅਤੇ ਗੋਲ ਵੀ ਬਣ ਜਾਂਦੇ ਆ ਗੋਲ ਵੀ ਬਣ ਜਾਂਦੇ ਆ ਉਸ ਤੋਂ ਉਪਰੰਤ ਜਿਹੜਾ ਕਿ ਮਤਲਬ ਜਿਹੜਾ ਜਿਸ ਤਰ੍ਹਾਂ ਵੀ ਕਸਟਮਰ ਚਾਹੇ ਉਵੇਂ ਹੀ ਡਿਜਾਇਨ ਤਿਰ ਤਿਆਰ ਕੀਤੇ ਜਾਂਦੇ ਆ ਸਿੱਧੀਆਂ ਲਾਇਨਾਂ ਮਾਰ ਕੇ ਵੀ ਤਿਆਰ ਕੀਤੇ ਜਾਂਦੇ ਆ ਲੇਜੀਜ ਵਗੈਰਾ ਵੀ ਲਾ ਕੇ ਤਿਆਰ ਕੀਤੇ ਜਾਂਦੇ ਆ ਅਤੇ ਜਿਹੜੇ ਸਕਰੋਲ ਆ ਉਹ ਸਹੀ ਢੰਗ ਨਾਲ ਵੱਜੇ ਹੋਣ ਹਲਾਂ ਜਿਸ ਜਿਸਦੇ ਹਿਸਾਬ ਨਾਲ ਯਾਨੀ ਕਿ ਉਹ ਕਸਟਮਰ 'ਤੇ ਚੰਗਾ ਪ੍ਰਭਾਵ ਪੈਂਦਾ ਉਹਦੇ ਨਾਲ ਆਪਣੇ ਕਸਟਮਰ ਵੀ ਵਧੀਆ ਬਣਦੇ ਨੇ ਜੀ ਆਪਾਂ ਕੱਪੜੇ ਦੀ ਸਫਾਈ ਦੇਵਾਂਗੇ ਕਸਟਮਰ ਵਧੀਆ ਬਣਦੇ ਆ ਚੰਗਾ ਸਤਿ ਸ਼੍ਰੀ ਅਕਾਲ